ਵੈਸੇ ਤਾਂ ਮੈਨੂੰ ਸੰਗੀਤ ਵਿੱਚ ਸਾਰੇ ਹੀ ਗੀਤ ਪਸੰਦ ਹਨ ਕਿਉਂਕਿ ਇਹ ਵੱਖ ਵੱਖ ਮੌਕੇ 'ਤੇ ਵੱਖ ਵੱਖ ਗੀਤ ਗਾਏ ਅਤੇ ਸੁਣੇ ਜਾਂਦੇ ਹਨ ਇੱਕ ਸੰਗੀਤ ਹੀ ਐਸਾ ਸਰੋਤ ਹੈ ਜੋ ਹਰ ਵੱਖਰੇ ਟਾਈਪ 'ਤੇ ਵੱਖਰਾ ਮਾਹੌਲ ਬਣਾਉਂਦੇ ਹਨ ਜੇ ਮੇਰਾ ਮਨ ਕਿਤੇ ਉਦਾਸ ਹੁੰਦਾ ਹੈ ਤਾਂ ਮੈਂ ਉਦਾਸੀ ਭਰੇ ਗੀਤ ਸੁਣਦੀ ਹਾਂ ਇਕੱਲੀ ਬੈਠ ਕੇ ਜੇਕਰ ਮੈਂ ਖੁਸ਼ ਹੋਵਾਂ ਤਾਂ ਮੈਂ ਖੁਸ਼ੀ ਭਰੇ ਗੀਤ ਸੁਣਦੀ ਹਾਂ ਮੈਂ ਹੈਡਫੋਨ ਲਗਾ ਕੇ ਰਾਤ ਨੂੰ ਮੈਡੀਟੇਸ਼ਨ ਗੀਤ ਸੁਣਦੀ ਹਾਂ ਉਸ ਵੇਲੇ ਮੈਨੂੰ ਬੜਾ ਸਕੂਨ ਭਰਿਆ ਲੱਗਦਾ ਹੈ ਮੈਨੂੰ ਬੜੀ ਚੰਗੀ ਨੀਂਦ ਆ ਜਾਂਦੀ ਹੈ ਅਤੇ ਮਨ ਵੀ ਸ਼ਾਂਤ ਰਹਿੰਦਾ ਹੈ ਗੀਤ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਏ ਹਨ ਮੇਰੇ ਪਸੰਦੀਦਾ ਗੀਤ ਜਗਜੀਤ ਸਿੰਘ ਦੀ ਗ਼ਜ਼ਲਾਂ ਹਨ ਮੇਰੇ ਮਨ ਨੂੰ ਭਾਉਂਦੀਆਂ ਹਨ ਮੈਨੂੰ ਸਕੂਨ ਜਿਹਾ ਮਿਲਦਾ ਹੈ ਜਗਜੀਤ ਸਿੰਘ ਦੀਆਂ ਗ਼ਜ਼ਲਾਂ ਸੁਣ ਕੇ ਪੰਜਾਬੀ ਗੀਤ ਮੈਨੂੰ ਤਾਂ ਭਾਅ ਜਾਂਦੇ ਹਨ ਗ਼ਜ਼ਲਾਂ ਖਾਸ ਕਰਕੇ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਗੀਤ ਅਤੇ ਸੰਗੀਤ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਏ ਹਨ ਵੱਖ ਵੱਖ ਮੌਕਿਆ 'ਤੇ ਵੱਖ ਵੱਖ ਜਗ੍ਹਾ 'ਤੇ ਗੀਤ ਗਾਣੇ ਚੰਗੇ ਲੱਗਦੇ ਹਨ ਅੱਜ ਕੱਲ੍ਹ ਤਾਂ ਵਿਆਹ ਸ਼ਾਦੀਆਂ ਦੇ ਮਾਹੌਲਾਂ 'ਤੇ ਬਹੁਤ ਗੀਤ ਪ੍ਰਚੱਲਿਤ ਹੋ ਗਏ ਹਨ ਬਿਨਾਂ ਗੀਤਾਂ ਤੋਂ ਨੱਚਣਾ ਟੱਪਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਅਤੇ ਨਾ ਹੀ ਉਹ ਮਾਹੌਲ ਨੂੰ ਇੱਕ ਯਾਦਗਾਰ ਬਣਾਉਂਦਾ ਹੈ ਵਿਆਹ ਸ਼ਾਦੀਆਂ 'ਤੇ ਜਿੰਨਾ ਚਿਰ ਗੀਤ ਨਾ ਵੱਜਣ ਉੰਨੀ ਦੇਰ ਵਿਆਹ ਦਾ ਮਾਹੌਲ ਬਣਦਾ ਹੀ ਨਹੀਂ ਗੀਤ ਸੁਣਨਾ ਅਤੇ ਸੁਣਾਉਣਾ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ